ਮੇਰਾ ਪਹਿਲਾ ਪ੍ਰੋਡਕਟ ਮੋਬਾਇਲ ਫ਼ੋਨ ਜੋ ਕਿ ਇੱਕ ਸੈਮਸੰਗ ਕੰਪਨੀ ਦਾ ਹੈ ਮੈਨੂੰ ਇਹ ਬਹੁਤ ਪਸੰਦ ਆਇਆ ਹੈ ਕਿਉਂਕਿ ਇਹਦੇ ਵਿੱਚ ਕਾਫ਼ੀ ਫੀਚਰਸ ਹਨ ਇਹਦਾ ਬੈਟਰੀ ਬੈਕਅੱਪ ਵੀ ਬਹੁਤ ਵਧੀਆ ਹੈ ਇਸਦੀ ਸਕਰੀਨ ਬਹੁਤ ਵੱਡੀ ਹੈ ਅਤੇ ਇਹ ਬਿਲਕੁਲ ਵੀ ਹੈਂਗ ਨਹੀਂ ਹੁੰਦਾ ਇਹਦੇ ਵਿੱਚ ਬੜੀ ਹੀ ਆਸਾਨੀ ਦੇ ਨਾਲ਼ ਕੁਛ ਵੀ ਸਰਚ ਕਿਤ ਕਰ ਲੈਂਦੀ ਹਾਂ ਜਿਸ ਤਰ੍ਹਾਂ ਮੈਨੂੰ ਕੋਈ ਵੀ ਦਿੱਕਤ ਨਹੀਂ ਹੁੰਦੀ ਇਹਦੇ ਵਿੱਚ ਵਾਈਫਾਈ ਦਾ ਕਨੈਕਸ਼ਨ ਵੀ ਲਿਆ ਹੈ ਜੋ ਕਿ ਬਹੁਤ ਹੀ ਵਧੀਆ ਹੈ ਅਤੇ ਫਾਸਟ ਚੱਲਦਾ ਹੈ ਇਹਦੇ ਵਿੱਚ ਹੋਰ ਵੀ ਬਹੁਤ ਸਾਰੇ ਫੀਚਰ ਹਨ ਜਿਸ ਦੇ ਨਾਲ਼ ਮੈਨੂੰ ਮੋਬਾਇਲ ਵੀ ਯੂਜ਼ ਕਰਨਾ ਹੋਰ ਵੀ ਸੌਖਾ ਹੋ ਗਿਆ ਹੈ ਅਤੇ ਇਹ ਫ਼ੋਨ ਬਹੁਤ ਹੀ ਵਧੀਆ ਹੈ